ਹੈਂਡ ਪੰਪ ਪਹਿਲਾਂ ਬੋਰ ਕੀਤਾ ਜਾਂਦਾ ਹੈ ਫਿਰ ਵਿ ਉਸ ਦੇ ਵਿੱਚ ਇੱਕ ਪਾਈਪ ਪਾਈ ਜਾਂਦੀ ਹੈ ਅਤੇ ਥੱਲੇ ਸਭ ਤੋਂ ਫਿਲਟਰ ਹੁੰਦਾ ਹੈ ਅਤੇ ਇੱਕ ਲੋਹੇ ਦੀ ਰਾੜ ਹੁੰਦੀ ਹੈ ਉਹ ਪਾਈਪ ਦੇ ਵਿੱਚ ਉਹਦੇ ਨਾਲ ਬੋਕੀ ਲੱਗੀ ਹੁੰਦੀ ਹੈ ਅਤੇ ਉੱਪਰ ਉਹਦੇ ਨਾਲ ਹੱਥੀ ਲੱਗੀ ਹੁੰਦੀ ਹੈ ਜਦੋਂ ਅਸੀਂ ਹੱਥੀ ਨੂੰ ਉੱਪਰ ਹੇਠਾਂ ਕਰਦੇ ਹਾਂ ਤਾਂ ਪਾਣੀ ਸਾਡਾ ਨਿਕਲਦਾ ਹੈ ਅਤੇ ਜਦੋਂ ਗਰਮੀਆਂ ਹੁੰਦੀਆਂ ਉਦੋਂ ਪਾਣੀ ਜਿਹੜਾ ਉਹ ਥੱਲੇ ਚਲੇ ਜਾਂਦਾ ਪਾਣੀ ਦਾ ਲੈਵਲ ਥੱਲੇ ਘੱਟ ਬਹੁਤ ਘੱਟ ਜਾਂਦਾ ਅਤੇ ਜਿਹੜਾ ਹੈਂਡ ਪੰਪ ਆ ਉਹ ਪਾਣੀ ਬਹੁਤ ਘੱਟ ਕੱਢਦਾ ਅਤੇ ਉਦੋਂ ਪਾਣੀ ਦੀ ਸ਼ੌਰਟ ਦੇ ਨਾਲ ਕਾਫੀ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਾਹ ਅਸੀਂ ਤਾਂ ਸਾਰਿਆਂ ਨੇ ਲਾਈਨ ਲਗਾ ਕੇ ਬਹਿ ਜਾਣਾ ਅਤੇ ਜਿਵੇਂ ਅਸੀਂ ਇੱਕ ਨੇ ਭਰਿਆ ਪਾਣੀ ਅਤੇ ਫਿਰ ਦੂਜੇ ਦੀ ਵਾਰੀ ਆਈ ਅਤੇ ਕਾਫੀ ਵੇਟ ਕਰਨੀ ਪੈਂਦੀ ਆ ਜਿਹੜਾ ਕਿ ਅੱਜ ਕੱਲ੍ਹ ਹੁਣ ਆਪਾਂ ਹੈਂਡ ਪੰਪਾਂ ਦੀ ਜਗ੍ਹਾ ਮੋਟਰਾਂ ਨੇ ਲੈ ਲਈ ਹੈ ਅੱਜ ਦੇ ਸਮੇਂ ਵਿੱਚ ਪਾਣੀ ਕੱਢਣਾ ਜਿਹੜਾ ਸੌਖਾ ਹੈ ਮੋਟਰ ਦੇ ਨਾਲ ਪਾਣੀ ਜਲਦੀ ਭਰਦਾ ਜਿਹੜਾ ਹੈਂਡ ਪੰਪ ਦੇ ਨਾਲ ਸੀ ਉਹਦੇ ਨਾਲ ਕਾਫੀ ਦੇਰ ਤੱਕ ਇੱਕ ਬਾਲਟੀ ਪਾਣੀ ਦੀ ਭਰਦੀ ਸੀ ਉਹਨਾਂ ਹੈਂਡ ਪੰਪ ਦੇ ਜਦੋਂ ਗਰਮੀਆਂ ਦੇ ਵਿੱਚ ਉਹਨੇ ਜ਼ਿਆਦਾ ਪਾਣੀ ਥੱਲੇ ਚਲੇ ਜਾਣਾ ਤਾਂ ਫਿਰ ਕਾਫੀ ਮੁਸ਼ਕਲ ਹੋਣੀ ਅੱਜ ਕੱਲ੍ਹ ਹੈਂਡ ਪੰਪ ਦਾ ਹੁਣ ਕੰਮ ਬਹੁਤ ਘੱਟ ਗਿਆ ਹੈ ਹਾਂਜੀ